ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਮਹੱਤਤਾ ਹੈ ਭੰਗੜਾ ਸਦੀਆਂ ਤੋਂ ਚਲਦਾ ਆ ਰਿਹਾ ਹੈ ਅਤੇ ਭੰਗੜਾ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਭੰਗੜਾ ਪੰਜਾਬੀਆਂ ਦੀ ਸ਼ਾਨ ਹੈ ਅਤੇ ਭੰਗੜਾ ਬਹੁਤ ਹੀ ਬਹੁਤ ਹੀ ਤਿਉਹਾਰਾਂ ਜਾਂ ਫੰਕਸ਼ਨਾਂ 'ਤੇ ਪਾਇਆ ਜਾ ਸਕਦਾ ਹੈ ਇਹ ਭੰ ਭੰਗੜਾ ਪੰਜਾਬੀਆਂ ਲਈ ਮਹੱਤਵਪੂਰਨ ਹੈ ਭੰਗੜਾ ਸਕੂਲਾਂ ਕਾਲਜਾਂ ਅਤੇ ਹੋਰ ਕਈ ਫੰਕਸ਼ਨਾਂ ਉੱਤੇ ਪਾਇਆ ਜਾ ਸਕਦਾ ਹੈ ਜਿਵੇਂ ਕਿ ਲੋਹੜੀ ਦੇ ਤਿਉਹਾਰ ਵੇਲੇ ਦੀਵਾਲੀ ਵੇਲੇ ਵਿਸਾਖੀ ਦੇ ਵੇਲੇ ਆਦਿ ਪਾਇਆ ਜਾ ਸਕਦਾ ਹੈ ਅਤੇ ਭੰਗੜੇ ਦਾ ਪਹਿਰਾਵਾ ਕੁੜਤਾ ਚਾਦਰਾ ਕੜਾ ਰੁਮਾਲ ਨੋਕ ਵਾਲੀ ਜੁੱਤੀ ਟੋਰੇ ਵਾਲੀ ਪੱਗ ਆਦਿ ਹੁੰਦਾ ਹੈ ਜਿਸ ਨਾਲ ਭੰਗੜੇ ਵਾਲੇ ਭੰਗੜੇ ਭੰਗੜਾ ਬਹੁਤ ਹੀ ਸੋਹਣਾ ਲੱਗਦਾ ਹੈ ਅਤੇ ਲੋਕ ਉਹ ਭੰਗੜੇ ਵੱਲ ਆਕਰਸ਼ਿਤ ਹੁੰਦੇ ਹਨ ਅਤੇ ਇਹ ਭੰਗੜਾ ਪੰਜਾਬੀਆਂ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ